ਜੀ ਹਾਂ ਮੈਂ ਆਪਣੇ ਘਰ ਵਿੱਚ ਪੰਛੀਆਂ ਲਈ ਇੱਕ ਛੋਟੀ ਜਿਹੀ ਬਗੀਚੀ ਬਣਾਈ ਹੋਈ ਹੈ ਜਿਸ ਵਿੱਚ ਮੈਂ ਛੋਟੇ ਛੋਟੇ ਘਰ ਵੀ ਬਣਾਏ ਹੋਏ ਹਨ ਅਤੇ ਉਹਨਾਂ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ ਅਤੇ ਸਵੇਰੇ ਮੈਂ ਜਾ ਕੇ ਉਹਨਾਂ ਲਈ ਅਨਾਜ ਰੱਖਦੀ ਹਾਂ ਅਤੇ ਉਹਨਾਂ ਦੇ ਲਈ ਪਾਣੀ ਪੀਣ ਦੇ ਲਈ ਵੀ ਰੱਖਦੀ ਹਾਂ